ਵਿਆਹ ਸ਼ਾਦੀਆਂ ਅਤੇ ਹੋਰ ਵੱਡੇ ਸਮਾਗਮਾਂ ਵਿੱਚ ਪਾਣੀ ਦੀ ਲੋੜ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਵੇਂ ਕਿ ਕਹਿੰਦੇ ਨੇ ਪਾਣੀ ਬਿਨਾਂ ਕੋਈ ਜ਼ਿੰਦਗੀ ਨਹੀਂ ਪਾ ਜਿਵੇਂ ਕਹਿੰਦੇ ਨੇ ਕਿ ਜਲ ਹੈ ਤਾਂ ਕੱਲ੍ਹ ਹੈ ਪਾਣੀ ਦਾ ਪ੍ਰਬੰਧ ਜਿੱਥੇ ਕਿ ਖਾਣ ਪੀਣ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਪੂਰਾ ਧਿਆਨ ਨਾਲ ਕਰਨਾ ਰਿਸ਼ਤੇਦਾਰਾਂ ਨੇ ਨਹਾਉਣਾ ਰਹਿਣਾ ਸਹਿਣਾ ਆਦਿ ਸਭ ਕੰਮ ਪਾਣੀ ਨਾਲ ਹੀ ਮੁਮਕਿਨ ਹਨ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੇਖਣਾ ਚਾਹੀਦਾ ਹੈ ਕਿ ਪਾਣੀ ਦੀ ਬਰਬਾਦੀ ਬਿਲਕੁਲ ਨਾ ਹੋਵੇ ਅਤੇ ਲੋੜ ਅਨੁਸਾਰ ਹੀ ਪਾਣੀ ਦੀ ਵਰਤੋਂ ਕੀਤੀ ਜਾਵੇ ਸਾਨੂੰ ਸਮੇਂ ਸਿਰ ਟੈਂਕੀਆਂ ਭਰ ਲੈਣੀਆਂ ਚਾਹੀਦੀਆਂ ਹਨ ਅਤੇ ਪੀਣ ਵਾਸਤੇ ਪਾਣੀ ਦੀਆਂ ਵੱਖਰੀਆਂ ਬੋਟਲਸ ਦਾ ਇੰਤਜ਼ਾਮ ਰੱਖਣਾ ਚਾਹੀਦਾ ਹੈ ਅਤੇ ਟੈਂਕਰ ਵਿੱਚ ਪਾਣੀ ਐਮਰਜੈਂਸੀ ਲਈ ਸਟੋਰ ਕਰਕੇ ਰੱਖਣਾ ਚਾਹੀਦਾ ਹੈ ਤਾਂ ਜੋ ਲੋੜ ਪੈਣ 'ਤੇ ਉਸਦਾ ਇਸਤੇਮਾਲ ਕੀਤਾ ਜਾ ਸਕੇ